ਤੁਸੀਂ ਪੌਦੇ ਉਗਾਉਣ ਲਈ ਕਿਸ ਪ੍ਰਕਾਰ ਦੀ ਮਿੱਟੀ ਦੀ ਵਰਤੋਂ ਕਰਦੇ ਹੋ ਅਤੇ ਕੀ ਪੌਦਿਆਂ ਲਈ ਹਾਂਜੀ ਮੈਂ ਪੌਦੇ ਉਗਾਉਣ ਲਈ ਜ਼ਿਆਦਾਤਰ ਕੋਈ ਕੈਮੀਕਲ ਜਾਂ ਕਿਸੇ ਵੀ ਤਰ੍ਹਾਂ ਦਾ ਬਾਹਰੀ ਖਾਦ ਦੀ ਵਰਤੋਂ ਨਹੀਂ ਕਰਦੀ ਮੈਂ ਉਨ੍ਹਾਂ ਨੂੰ ਉਗਾਉਣ ਵਾਸਤੇ ਮਿੱਟੀ ਦਾ ਘਰ ਦੀ ਹੀ ਰੂੜ੍ਹੀ ਦੀ ਵਰਤੋਂ ਕਰਦੀ ਹਾਂ ਜਿੰਨਾ ਵੀ ਘਰ ਦੇ ਵਿੱਚ ਜਿਸ ਤਰ੍ਹਾਂ ਆਪਣੀਆਂ ਸਬਜ਼ੀਆਂ ਦਾ ਫ਼ਲਾਂ ਦਾ ਵੇਸਟੇਜ ਹੁੰਦਾ ਹੈ ਜੋ ਆਪਣੇ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਰਸੋਈ ਦਾ ਵੇਸਟੇਜ ਹੁੰਦਾ ਹੈ ਮੈਂ ਉਹਨੂੰ ਵੀ ਉਹਨੂੰ ਵੀ ਮਿੱਟੀ 'ਚ ਦੱਬ ਕੇ ਪੌਦਿਆਂ ਦੇ ਲਾਗੇ ਲਾਗੇ ਪਾਉਣਾ ਪਸੰਦ ਕਰਦੀ ਹਾਂ ਮੈਂ ਉਨ੍ਹਾਂ ਨੂੰ ਹੀ ਖਾਦ ਦੀ ਤਰ੍ਹਾਂ ਵਰਤੋਂ ਕਰਦੀ ਹਾਂ ਮੈਂ ਕਦੀ ਵੀ ਕਿਸੇ ਬਾਹਰੀ ਕੈਮੀਕਲੀ ਪ੍ਰੋਡਕਟ ਦਾ ਜਾਂ ਕੈਮੀਕਲ ਖੁਰਾਕ ਦਾ ਯੂਸ ਨਹੀਂ ਕਰਦੀ ਕਿਉਂਕਿ ਮੈਂ ਜਿੰਨਾ ਹੋ ਸਕੇ ਉਨ੍ਹਾਂ ਨੂੰ ਕੁਦਰਤੀ ਤੌਰ 'ਤੇ ਜ਼ਮੀਨ ਦੇ ਨਾਲ ਜੁੜ ਕੇ ਮਿੱਟੀ ਦੇ ਨਾਲ ਮਿੱਟੀ ਦੀ ਤਾਕਤ ਲੈ ਕੇ ਉੱਗਦੇ ਨਾ ਦੇਖਣਾ ਚਾਹੁੰਦੀ ਹਾਂ

ਘੱਟ ਤੋਂ ਘੱਟ ਸਾਨੂੰ ਇਹਨਾਂ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਕਰਕੇ ਮੈਂ ਪੌਦਿਆਂ ਨੂੰ ਉਗਾਉਣ ਲਈ ਜ਼ਿਆਦਾਤਰ ਸਾਦਗੀ ਸਾਦੇ ਤਰੀਕੇ ਦੀ ਵਰਤੋਂ ਕਰਦੀ ਹਾਂ ਉਨ੍ਹਾਂ ਨੂੰ ਮਿੱਟੀ ਪੁੱਟ ਕੇ ਉਨ੍ਹਾਂ ਦੀ ਗੋਡੀ ਕਰਨਾ ਉਨ੍ਹਾਂ ਨੂੰ ਮਿੱਟੀ ਵਿੱਚ ਉਗਾਉਣਾ ਫਿਰ ਉਹਦੇ ਵਿੱਚ ਪਾਣੀ ਲਗਾਉਣਾ ਫਿਰ ਧੁੱਪ ਛਾਂ ਦਾ ਧਿਆਨ ਰੱਖਣਾ ਕੇ ਜਦੋਂ ਜ਼ਿਆਦਾ ਗਰਮੀ ਹੈ ਤਾਂ ਉਨ੍ਹਾਂ ਨੂੰ ਪਾਣੀ ਉਸ ਤਰੀਕੇ ਨਾਲ ਦਿੱਤਾ ਜਾਵੇ ਜਦੋਂ ਘੱਟ ਜ ਗਰਮੀ ਹੈ ਜਾਂ ਬਾਹਰ ਵਰਖਾ ਹੈ ਤਾਂ ਪਾਣੀ ਘੱਟ ਦਿੱਤਾ ਜਾਵੇ ਸੋ ਇਸ ਤਰੀਕੇ ਦੀਆਂ ਛੋਟੇ ਛੋਟੇ ਨੁਸਖਿਆਂ ਦਾ ਨੂੰ ਅਪਣਾ ਕੇ ਮੈਂ ਇਹ ਕੰਮ ਜਿਹੜਾ ਆਪਣਾ ਪੂਰਾ ਕਰਦੀ ਐ ਅਤੇ ਇਹਦੇ ਨਾਲ ਮੇਰੇ ਪੌਦੇ ਬਹੁਤ ਸੋਹਣੇ ਉੱਗ ਵੀ ਜਾਂਦੇ ਨੇ ਅਤੇ ਉਨ੍ਹਾਂ ਦੀ ਗ੍ਰੋਥ ਵੀ ਕਾਫ਼ੀ ਅੱਛੀ ਹੋ ਜਾਂਦੀ ਹੈ ਉਨ੍ਹਾਂ ਦੀ ਗ੍ਰੋਥ ਵਿੱਚ ਕਦੀ ਵੀ ਇਹ ਚੀਜ਼ ਦੀ ਜ਼ਰੂਰਤ ਨਹੀਂ ਲੱਗੀ ਕਿ ਮੈਨੂੰ ਕੋਈ ਬਾਹਰੀ ਖਾਦ ਵਰਤਣੀ ਪਏਗੀ ਸੋ ਮੈਂ ਘਰ ਦੀ ਹੀ ਮਿੱਟੀ ਵਰਤ ਕੇ ਕੱਚੇ ਥਾਂ ਤੋਂ ਉਨ੍ਹਾਂ ਦੀ ਜੁਜੁ ਵਰਤੋਂ ਕਰਕੇ ਪਾਣੀ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਉਗਾ ਲੈਂਦੀ ਹਾਂ ਮੈਨੂੰ ਕਿਸੇ ਵੀ ਤਰੀਕੇ ਦੀ ਹੋਰ ਚੀਜ਼ ਦੀ ਲੋੜ ਜਿਹੜੀ ਹੈ ਨਹੀਂ ਪੈਂਦੀ ਹੈਗੀ